ਮੇਰੇ ਕੋਲ ਕੋਈ ਖਾਸ ਵਿਸ਼ਾ ਜਾਂ ਥੀਮ ਤਾਂ ਨਹੀਂ ਹੁੰਦੀ ਮੈਂ ਜੋ ਵੀ ਬਣਾਉਣਾ ਹੁੰਦਾ ਹੈ ਉਹ ਮੈਂ ਸ਼ੋਸ਼ਲ ਮੀਡੀਆ ਰਾਹੀਂ ਇੰਸਟਾਗਰਾਮ ਸਨੈਪਚੈਟ ਜਾਂ ਫਿਰ ਫੇਸਬੁੱਕ ਆਦਿ ਤੋਂ ਦੇਖ ਕੇ ਯੂਟਿਊਬ ਤੋਂ ਦੇਖ ਕੇ ਬਣਾ ਲੈਂਦੀ ਹਾਂ ਅਤੇ ਉਸ ਮੈਨੂੰ ਅ ਡਰਾਇੰਗ ਵਿੱਚ ਬਣਾ ਚੀਜ਼ਾਂ ਬਣਾਉਣੀਆਂ ਕੁਦਰਤੀ ਚੀਜ਼ਾਂ ਬਣਾਉਣੀਆਂ ਬਹੁਤ ਜ਼ਿਆਦਾ ਪਸੰਦ ਹਨ ਜੋ ਮੇਰੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਦਿੰਦੀਆਂ ਹਨ ਮੈਨੂੰ ਅਜਿਹੀ ਚੀਜ਼ਾਂ ਹੀ ਜਿਵੇਂ ਪੇੜ ਪੌਦੇ ਪਰਬਤ ਫੁੱਲ ਆਦਿ ਬਣਾਉਣੇ ਬਹੁਤ ਪਸੰਦ ਹਨ ਕਿਉਂਕਿ ਇਹ ਮੇਰੇ ਮਨ ਨੂੰ ਸ਼ਾਂਤੀ ਦਿੰਦੇ ਹਨ